ਹੈਲੋ ਹਾਂਜੀ ਤੁਸੀਂ ਐਮਾਜੋਨ ਤੋਂ ਬੋਲ ਰਹੇ ਓਂ ਹਾਂ ਜੀ ਮੈਂ ਤੁਹਾਡੇ ਤੋਂ ਇੱਕ ਫੋਨ ਚਾਰਜਰ ਮੰਗਵਾਇਆ ਸੀ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਮੇਰੇ ਬ੍ਰਦਰ ਨੇ ਹੀ ਮੈਨੂੰ ਦੱਸਿਆ ਸੀ ਕਿ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਓਂ ਕਿਉਂਕਿ ਮੈਂ ਆਪਣੇ ਬ੍ਰਦਰ ਨੂੰ ਕਿਹਾ ਸੀ ਵੀ ਮੈਨੂੰ ਸ਼ਹਿਰ ਤੋਂ ਚਾਰਜਰ ਲਿਆ ਕੇ ਦੇ ਦਿਉ ਲੇਕਿਨ ਉਸ ਕੋਲ ਟਾਈਮ ਦੀ ਕਮੀ ਸੀ ਇਸ ਕਰਕੇ ਮੈਂ ਪਹਿਲੀ ਵਾਰ ਹੀ ਇਹ ਆਰਡਰ ਕੀਤਾ ਸੀ ਅਤੇ ਮੈਨੂੰ ਬਹੁਤ ਵਧੀਆ ਮਿਲਿਆ ਇੱਕ ਤਾਂ ਸਾਡਾ ਜਿਹੜਾ ਪਿੰਡ ਆ ਉਹ ਸ਼ਹਿਰ ਤੋਂ ਪੱਚੀ ਤੀਹ ਕਿਲੋਮੀਟਰ ਪੈਂਦਾ ਹੈ ਅਤੇ ਦੂਸਰਾ ਜਿਹੜੀ ਸਮੇਂ ਦੀ ਵੀ ਬੱਚਤ ਹੋਈ ਫਿਰ ਥਰਟੀ ਪਰਸੈਂਟ ਹੈ ਜਿਹੜਾ ਉਹ ਡਿਸਕੋਂਟ ਵੀ ਮਿਲਿਆ ਅਤੇ ਨਾਲ ਹੀ ਜਿਹੜੀ ਇਹਦੀ ਡਿਲੀਵਰੀ ਸੀ ਉਹ ਵੀ ਸਹੀ ਟਾਈਮ 'ਤੇ ਹੋਈ ਅਤੇ ਡਿਲੀਵਰੀ ਲੜਕੇ ਨੇ ਵੀ ਬਹੁਤ ਅੱਛੇ ਹੈ ਬਿਹੇਵੀਅਰ ਨਾਲ ਜਿਹੜਾ ਸੀਗਾ ਚਾਰਜਰ ਜਾਂ ਆਪਣਾ ਕੰਮ ਕੀਤਾ ਅਤੇ ਮੈਂ ਸੋਚ ਰਹੀ ਹਾਂ ਕਿ ਸ਼ਾਇਦ ਅੱਗੇ ਤੋਂ ਵੀ ਕੁਛ ਨਾ ਕੁਛ ਜਿਹੜੀਆਂ ਚੀਜ਼ਾਂ ਨੇ ਅਸੀਂ ਆਨਲਾਈਨ ਹੀ ਮੰਗਵਾਈਏ ਅਤੇ ਜਿਸ ਦੇ ਨਾਲ ਸਾਡੀ ਜਿਹੜੀ ਹੈਗੀ ਉਹ ਹਰ ਤਰ੍ਹਾਂ ਦੀ ਜਿਵੇਂ ਸਾਨੂੰ ਸਹੂਲਤ ਮਿਲ ਰਹੀ ਹੈ ਸਾਨੂੰ ਉਸ ਦਾ ਜਿਹੜਾ ਗਾ ਫਾਇਦਾ ਉਠਾਉਣਾ ਚਾਹੀਦਾ ਹੈਗਾ ਅਤੇ ਨਾਲ ਨਾਲ ਜਿਹੜੀ ਇਹਦੇ ਵਿੱਚ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ